ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਮਿਲ ਜੇਗਾ ਜੀ ਬੱਕਰੇ ਦਾ ਭਾਅ ਜੀ ਆਪਣਾ ਛੇ ਸੌ ਰੁਪਏ ਚਲਦਾ ਜੀ ਅਤੇ ਮੁਰਗਾ ਜੀ ਡੇਢ ਸੌ ਰੁਪਏ ਹਾਂਜੀ ਅਤੇ ਬੱਕਰੇ ਦਾ ਆਪਣਾ ਇੱਦਾਂ ਕਿ ਅਲੱਗ ਅਲੱਗ ਤਰ੍ਹਾਂ ਦੀ ਹਰੇਕ ਬੰਦੇ ਦੀ ਆਪਣੀ ਚੋਇਸ ਹੁੰਦੀ ਏ ਅਤੇ ਦੋ ਤਰ੍ਹਾਂ ਦਾ ਬੱਕਰਾ ਆਪਣੇ ਕੋਲ ਜ਼ਿਆਦਾਤਰ ਹੁੰਦਾ ਤਾਂ ਕਈ ਬੁੱਢਾ ਪਰੈਫਰ ਕਰਦੇ ਨੇ ਬੱਕਰਾ ਅਤੇ ਕਈ ਲਿਆਰਾ ਪੀਸ ਮੰਗਦੇ ਆ ਉਹ ਆਪਣਾ ਦੱਸ ਦਿਓ ਉਸ ਹਿਸਾਬ ਨਾਲ ਲਿਆਰਾ ਆਪਣਾ ਸਾਢੇ ਛੇ ਸੌ ਰੁਪਏ ਚੱਲਦਾ ਜੀ ਬੁੱਢਾ ਆਪਣਾ ਛੇ ਸੌ ਰੁਪਏ ਚਲਦਾ ਅਤੇ ਲਿਆਰਾ ਸਾਢੇ ਛੇ ਸੌ ਚੱਲਦਾ ਹਾਂਜੀ ਕੋਈ ਗੱਲ ਨਹੀਂ ਭਾਅ ਜੀ ਕੋਈ ਗੱਲ ਨਹੀਂ ਕਰ ਲਵਾਂਗੇ ਜੀ ਆਪਣਾ ਦੋ ਸੌ ਬੰਦੇ ਦਾ ਪ੍ਰੋਗਰਾਮ ਜੀ ਆਪਣਾ ਠੀਕ ਹੈ ਜੀ ਠੀਕ ਹੈ ਆਪਣਾ ਠੀਕ ਹੈ ਜੀ ਅਤੇ ਮੁਰਗਾ ਜੀ ਠੀਕ ਹੈ ਦੋ ਸੌ ਬੰਦੇ ਲਈ ਹੈ ਨਾ ਜੀ ਬਸ ਠੀਕ ਆ ਆਪਾਂ ਤੀਹ ਤੀਹ ਕਿੱਲੋ ਕਰ ਦਿੰਦੇ ਹਾਂ ਜੀ ਬਾਕੀ ਤੁਸੀਂ ਆਪਣਾ ਵੇਖ ਲਉ ਦੋ ਸੌ ਬੰਦੇ 'ਚੋਂ ਜੀ ਪੰਜਾਹ ਸੱਠ ਬੰਦੇ ਹੁੰਦੇ ਨੇ ਜੀ ਬਸ ਖਾਣ ਵਾਲੇ ਹਾਂਜੀ ਹਾਂਜੀ ਹਾਂਜੀ ਅਤੇ ਮੁਰਗੇ ਦਾ ਭਾਅ ਜੀ ਇੱਕ ਉਹ ਆਪਣਾ ਦੱਸ ਦਿਓ ਚੈਸਟ ਦਾ ਅਤੇ ਲੈੱਗ ਦਾ ਅਲੱਗ ਅਲੱਗ ਅਤੇ ਚੈਸਟ ਕਿੰਨੀ ਚੀ ਦੋਵੇਂ ਚਾਹੀਦੀਆਂ ਬਰਾਬਰ ਪੀਸ ਕਰ ਦਈਏ ਦੋਵਾਂ ਦੇ ਠੀਕ ਹੈ ਜੀ ਠੀਕ ਹੈ ਠੀਕ ਹੈ ਅਤੇ ਸਨੋਰ ਦੱਸਿਆ ਜੀ ਭਾਅ ਜੀ ਤੁਸੀਂ ਅਡਰੈਸ ਹੈ ਨਾ ਜੀ ਅਤੇ ਠੀਕ ਆ ਠੀਕ ਆ ਅਤੇ ਆਪਾਂ ਉੱਥੇ ਪਹੁੰਚ ਕਰਨੀ ਹੈ ਤੁਸੀਂ ਆਪਣਾ ਲੈ ਕੇ ਆਉਂਗੇ ਵਹੀਕਲ ਅੱਛਾ ਜੀ ਹਾਂਜੀ ਹਾਂ ਆਪਣੇ ਆਟੋ ਚਲਦੇ ਹੈ ਭਾਅ ਜੀ ਪੰਜ ਸੌ ਰੁਪਈਆ ਲੈਂਦਾ ਕਿਰਾਇਆ ਉਹ ਅਤੇ ਓਹ 'ਤੇ ਭੇਜ ਦਾ ਨਹੀਂ ਕੋਈ ਗੱਲ ਨਹੀਂ ਉਹ ਆਪਾਂ ਬਾਅਦ 'ਚ ਕਰ ਲਵਾਂਗੇ ਜੀ ਮੈਨੂੰ ਤਰੀਕ ਇੱਕ ਵਾਰੀ ਦੁਬਾਰਾ ਲਿਖਾ ਦਿਓ ਜੀ ਚੌਦ੍ਹਾਂ ਜਨਵਰੀ ਠੀਕ ਹੈ ਜੀ ਅਤੇ ਆਪਣਾ ਦਿਨ ਦਾ ਪ੍ਰੋਗਰਾਮ ਹੈ ਜੀ ਠੀਕ ਹੈ ਜੀ ਠੀਕ ਹੈ ਭਾਅ ਜੀ ਅੱਠ ਵਜੇ ਤੁਹਾਡਾ ਸਮਾਨ ਪਹੁੰਚ ਜੇਗਾ ਸਵੇਰੇ ਜੀ ਹਾਂਜੀ ਹਾਂ ਠੀਕ ਹੈ ਜੀ ਭਾਅ ਜੀ ਓਕੇ ਜੀ ਓਕੇ ਧੰਨਵਾਦ